ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਮੈਂ ਖਰੜ ਤੋਂ ਬੋਲ ਰਿਹਾ ਜੀ ਤੁਸੀਂ ਮੋਹਾਲੀ ਗਰੇਅ ਮੈਟਰ ਆਇਲਟਸ ਸੈਂਟਰ ਤੋਂ ਬੋਲਦੇ ਹੋ ਜੀ ਮੈਂ ਪਤਾ ਕਰਨਾ ਸੀਗਾ ਜੀ ਆਇਲੈਟਸ ਦਾ ਰੇਟ ਵਗੈਰਾ ਵੀ ਕੀ ਸਿਸਟਮ ਕਿੰਨਾ ਹੁੰਦਾ ਜੀ ਮਹੀਨੇ ਦਾ ਫੀਸ ਵਗੈਰਾ ਮੈਂ ਕੈਨੇਡਾ ਜਾਣਾ ਚਾਹੁੰਦਾ ਸੀ ਜੀ ਹਾਂਜੀ ਅਤੇ ਕਿੰਨੀ ਫੀਸ ਹੁੰਦੀ ਹੈ ਜੀ ਅੱਛਾ ਜੀ ਅਤੇ ਕਿੰਨੇ ਕੁ ਬੈਂਡ ਚਾਹੀਦੇ ਹੁੰਦੇ ਆ ਜੀ ਇੱਕ ਕੈਨੇਡਾ ਜਾਣ ਖਾਤਰ ਅੱਛਾ ਓਵਰਆਲ ਛੇ ਜੀ ਹੈ ਜੀ ਠੀਕ ਹੈ ਜੀ ਚੱਲੋ ਠੀਕ ਹੈ ਮੈਡਮ ਮੈਂ ਤੁਹਾਨੂੰ ਪਤ ਘਰਦਿਆਂ ਤੋਂ ਪੁੱਛ ਕੇ ਦੱਸਦਾ ਜੀ ਫਿਰ